ਹਾਂਜੀ ਮੈਨੂੰ ਮੇਰੇ ਦੋਸਤ ਨੇ ਇੱਕ ਕਿਤਾਬ ਦਿੱਤੀ ਸੀ ਜਿਸਦਾ ਨਾਂ ਅਵਚੇਤਨ ਮਨ ਦੀ ਸ਼ਕਤੀ ਸੀ ਜੋ ਕੋਈ ਵੀ ਇਸ ਕਿਤਾਬ ਨੂੰ ਪੜ੍ਹਦਾ ਹੈ ਹੌਲੀ ਹੌਲੀ ਉਸਦੀ ਜ਼ਿੰਦਗੀ 'ਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ ਉਸ ਕਿਤਾਬ ਵਿੱਚੋਂ ਮੈਂ ਵੀ ਬਹੁਤ ਕੁਛ ਸਿੱਖਿਆ ਹੈ ਉਸ ਕਿਤਾਬ ਵਿੱਚ ਹਰ ਗੱਲ ਨੂੰ ਹਰ ਚੀਜ਼ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਹੈ ਉਸ ਵਿੱਚ ਦੱਸਿਆ ਹੈ ਕਿ ਕਿੱਦਾਂ ਅਸੀਂ ਆਪਣੇ ਮਨ ਨੂੰ ਕਾਬੂ 'ਚ ਰੱਖ ਸਕਦੇ ਹਾਂ ਅਤੇ ਸਾਰੀਆਂ ਚੀਜ਼ਾਂ ਵੱਲ ਧਿਆਨ ਦੇ ਸਕਦੇ ਹਾਂ ਇਹੋ ਜਿਹੀ ਵਿਸ਼ੇ ਦੀ ਕਿਤਾਬ ਨੂੰ ਪੜ੍ਹ ਕੇ ਅਸੀਂ ਮਾਨਸਿਕ ਤੌਰ 'ਤੇ ਸੰਤੁਸ਼ਟੀ ਪਾਉਂਦੇ ਹਾਂ ਅਤੇ ਆਪਣੇ ਆਤਮਿਕ ਸ਼ਾਂਤੀ ਅੱਜ ਦੇ ਮਨੁੱਖ ਦੇ ਮੁੱਢਲੀ ਲੋੜ ਹੈ ਮਾਨਸਿਕ ਤਨਾਅ ਨੂੰ ਦੂਰ ਕਰਨ ਦਾ ਚੰਗਾ ਸਾਧਨ ਕਿਤਾਬਾਂ ਹੀ ਹਨ ਇੰਟਰਨੈਟ ਦੇ ਇਸ ਯੁੱਗ 'ਚ ਭਾਵੇਂ ਸਾਡੇ ਕੋਲ ਗਿਆਨ ਦੇ ਆਧੁਨਿਕ ਸਾਧਨ ਹਨ ਪਰ ਕਿਤਾਬਾਂ ਦਾ ਮਹੱਤਵ ਹੀ ਸਾਨੂੰ ਉਹਦੇ ਤੱਕ ਲੈ ਕੇ ਜਾ ਸਕਦਾ ਹੈ ਅਤੇ ਇਸਦੇ ਲਈ ਅਸੀਂ ਕਦੇ ਵੀ ਇਨਕਾਰ ਨਹੀਂ ਕੀਤਾ ਅਤੇ ਸਾਨੂੰ ਇਸ ਦੇ ਮਹਾਨ ਖਜ਼ਾਨੇ ਨੂੰ ਸਾਂਭਣ ਦੀ ਲੋੜ ਹੈ ਅਤੇ ਅੱਗੇ ਵਧਾਉਣ ਦੀ ਲੋੜ ਹੈ